ਮੈਂ ਨਵਾਂ ਸ਼ਹਿਰ 'ਚ ਰਹਿੰਦੀ ਹਾਂ ਅਤੇ ਮਤਲਬ ਮੇਰੇ ਨੇੜੇ ਤੇੜੇ ਕਾਫੀ ਕਲੈਬਰੇਟ ਹਨ ਅਤੇ ਜਿਵੇਂ ਕਿ ਮੇਰੇ ਨੇੜੇ ਰੈਕ ਕੋਲੇਜ ਵੀ ਹੈ ਉਹਦੇ 'ਚ ਵੀ ਮਤਲਬ ਸਾਈਨਸ ਮੈਥ ਇੰਜੀਨੀਅਰਿੰਗ ਦੇ ਕਾਫੀ ਕੋਰਸ ਹਨ ਜਿਵੇਂ ਮਤਲਬ ਕਾਫੀ ਵਿਦਿਆਰਥੀ ਉੱਥੇ ਪੜ੍ਹਦੇ ਹਨ ਦੋ ਤੋਂ ਤਿੰਨ ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਅਤੇ ਉਹ ਕਾਫੀ ਨੋਲੇਜ ਵੀ ਲੈਂਦੇ ਹਨ ਇਸ ਕੋਲੇਜ ਵਿੱਚ ਕਾਫੀ ਕੁਛ ਵਧੀਆ ਸਿਖਾਇਆ ਜਾਂਦਾ ਹੈ ਅਤੇ ਦੂਰ ਦੂਰ ਤੋਂ ਵਿਦਿਆਰਥੀ ਇੱਥੇ ਆਉਂਦੇ ਹਨ ਅਤੇ ਮੈਂ ਮੈਨੂੰ ਆਹ ਕੋਲੇਜ ਬਹੁਤ ਹੀ ਵਧੀਆ ਪ ਲੱਗਦਾ ਹੈ ਕਿਉਂਕਿ ਉੱਥੇ ਮਤਲਬ ਨੌਲੇਜ ਬਹੁਤ ਹੀ ਜ਼ਿਆਦਾ ਵਧੀਆ ਦਿੰਦੇ ਹਨ ਅਤੇ ਜਿਵੇਂ ਸਾਈਨਸ ਮੈਥ ਇੰਜੀਨੀਅਰਿੰਗ ਤੋਂ ਅਲੱਗ ਅਲੱਗ ਵੀ ਕਾਫੀ ਉੱਥੇ ਨੌਲੇਜ ਹਨ ਯੂਨੀਵਰਸਿਟੀ ਸੰਸਥਾਵਾਂ ਬਹੁਤ ਹੀ ਜ਼ਿਆਦਾ ਉੱਥੇ ਵਧੀਆ ਹੈ ਅਤੇ ਉਹਨਾਂ ਦੀ ਪੇਸ਼ਕਸ਼ ਵੀ ਬਹੁਤ ਜ਼ਿਆਦਾ ਵਧੀਆ ਹੈ ਆਹ ਯੂਨੀਵਰਸਿਟੀ ਮੈਨੂੰ ਜਿਹੜੇ ਮੇਰੇ ਨੇੜੇ ਹੈ ਉਹ ਬਹੁਤ ਹੀ ਜ਼ਿਆਦਾ ਪਸੰ